ਮੈਂ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਸਿੱਖ ਧਰਮ ਇੱਕ ਬਹੁਤ ਵਧੀਆ ਸਭ ਤੋਂ ਉੱਤਮ ਧਰਮ ਹੈ ਜਿਸ ਵਿੱਚ ਕੋਈ ਵੀ ਗ਼ਲਤ ਧਾਰਨਾਵਾਂ ਨਹੀਂ ਹਨ ਅਤੇ ਇਹ ਇੱਕ ਚੰਗੇ ਨਾਗਰਿਕ ਚੰਗੇ ਇਨਸਾਨ ਅਤੇ ਦਸਮੇਸ਼ ਪਿਤਾ ਦੇ ਸਪੂਤ ਹੋਣ ਦਾ ਜੋ ਧਰਮ ਹੈ ਇਸ ਵਿੱਚ ਜੋ ਹੈ ਸਮਾਜ ਸੇਵਾ ਇਨਸਾਨੀਅਤ ਮਨੁੱਖਤਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਆਦਿ ਜਿਹੇ ਉਪਦੇਸ਼ ਦਿੱਤੇ ਗਏ ਹਨ ਜਿਨ੍ਹਾਂ ਦੇ ਉੱਤੇ ਚੱਲ ਕੇ ਸਾਡੇ ਗੁਰੂਆਂ ਨੇ ਸਾਨੂੰ ਇੰਗਜ਼ੈਮਪਲਸ਼ ਦੇ ਕੇ ਸਿੱਧ ਕੀਤਾ ਹੈ ਕਿ ਅਸੀਂ ਕਿਸ ਤਰ੍ਹਾਂ ਨਾਲ ਇੱਕ ਵਧੀਆ ਜੀਵਨ ਬਿਤਾਉਣਾ ਹੈ ਅਤੇ ਅਸੀਂ ਇੱਕ ਚੰਗੇ ਇਨਸਾਨ ਕਿਵੇਂ ਬਣਨਾ ਹੈ ਸਿੱਖ ਧਰਮ ਜੋ ਹੈ ਇਹ ਇੱਕ ਬਹੁਤ ਪੁਰਾਣਾ ਧਰਮ ਨਹੀਂ ਹੈ ਪਰ ਇਸਦੇ ਜੋ ਸਿੱਖਿਆਵਾਂ ਹਨ ਉਹ ਮਨੁੱਖਤਾ ਦੇ ਲਈ ਹਮੇਸ਼ਾ ਹੀ ਚਾਨਣ ਮੁਨਾਰਾ ਹਨ ਅਤੇ ਸਾਨੂੰ ਸਹੀ ਰਸਤੇ 'ਤੇ ਪਾਉਣ ਵਾਲੀਆਂ ਹਨ ਇਸ 'ਤੇ ਚੱਲ ਕੇ ਸਾਰੇ ਆਪਣਾ ਜੀਵਨ ਸਫ਼ਲ ਕਰ ਸਕਦੇ ਹਨ ਅਤੇ ਸਾਡੇ ਮਨ ਵਿੱਚ ਸਾਰੀਆਂ ਦੁਵਿਧਾਵਾਂ ਨੂੰ ਦੂਰ ਕਰਨ ਦੇ ਲਈ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਸਕਦੇ ਹਾਂ ਅਤੇ ਹਰ ਔਖੇ ਸੌਖੇ ਸਮੇਂ ਵਿੱਚ ਜੋ ਗੁਰੂ ਸਾਹਿਬ ਹਨ ਸਾਡੀ ਮਦਦ ਕਰਦੇ ਹਨ ਜੋ ਇਸ ਧਰਮ ਨੂੰ ਮੰਨਦੇ ਹਨ ਉਹ ਕਦੀ ਵੀ ਭਟਕਦੇ ਨਹੀਂ ਹਨ ਅਤੇ ਉਹਨਾਂ ਨੂੰ ਹਰ ਔਖੇ ਸੌਖੇ ਸਮੇਂ ਪਰਮਾਤਮਾ ਯਾਦ ਰਹਿੰਦਾ ਹੈ ਅਤੇ ਹਮੇਸ਼ਾ ਮਨੁੱਖਤਾ ਮਨੁੱਖ ਮਾਤਰ ਦੀ ਸੇਵਾ ਲਈ ਤਿਆਰ ਰਹਿੰਦੇ ਹਨ ਅਤੇ ਆਪਣੀ ਹਰ ਡਿਉਂਟੀ ਨੂੰ ਬਾਖੂਬੀ ਨਿਭਾਉਂਦੇ ਹਨ ਅਤੇ ਸਾਨੂੰ ਸਾਡੇ ਧਰਮ ਤੋਂ ਜੋ ਸਿੱਖਿਆਵਾਂ ਮਿਲਦੀਆਂ ਹਨ ਉਹਨਾਂ 'ਤੇ ਚੱਲ ਕੇ ਅਸੀਂ ਆਪਣਾ ਜੀਵਨ ਸਫਲ ਕਰ ਸਕਦੇ ਹਾਂ ਅਤੇ ਇਸਦੇ ਉੱਤੇ ਸਾਰਾ ਜੀਵਨ ਜੋ ਹੈ ਅਸੀਂ ਮਨੁੱਖਤਾ ਦੀ ਸੇਵਾ ਲਈ ਲਗਾ ਸਕਦੇ ਹਾਂ